ਭੰਗੜਾ ਐਰੋਬਿਕਸ ਸਰੀਰਿਕ ਗਤੀਵਿਧੀ ਦੇ ਤੌਰ 'ਤੇ ਵਧੀਆ ਕਸਰਤ ਹੈ ਇਹਦੇ ਉੱਪਰ ਮੇਰੇ ਵਿਚਾਰ ਹਨ ਕਿ ਜੀ ਹਾਂ ਇਹ ਇੱਕ ਬਹੁਤ ਹੀ ਵਧੀਆ ਕਸਰਤ ਹੈ ਇਹ ਜਦੋਂ ਆਪਾਂ ਕਿਉਂਕਿ ਮੇਰੇ ਹਿਸਾਬ ਦੇ ਨਾਲ ਜਦੋਂ ਆਪਾਂ ਭੰਗੜਾ ਪਾਈ ਦਾ ਉਦੋਂ ਸਾਡਾ ਸਾਰਾ ਸਰੀਰ ਹਿਲਦਾ ਹੈ ਉਹਦੇ ਨਾਲ ਕਿੰਨੀਆਂ ਬਿਮਾਰੀਆਂ ਜਿਹੜੀਆਂ ਆਪਾਂ ਸਾਡੀਆਂ ਹੁੰਦੀਆਂ ਸਾਡੇ ਅੰਦਰ ਉਹ ਆਪਾਂ ਪਸੀਨੇ ਦੇ ਥਰੂ ਸਾਡੇ ਅੰਦਰੋਂ ਦੀ ਬਾਹਰ ਨਿਕਲ ਜਾਂਦੀਆਂ ਜਿਨ੍ਹਾਂ ਦਾ ਕੀ ਸਾਡੇ ਸਰੀਰ ਦੇ ਵਿੱਚ ਰਹਿੰਦੀਆਂ ਜੇ ਉਹ ਤਾਂ ਹਾਨੀਕਾਰਕ ਹੋ ਸਕਦੀਆਂ ਸਨ ਪਰ ਜਦੋਂ ਆਪਾਂ ਭੰਗੜਾ ਪਾਈ ਦਾ ਹੈ ਤਾਂ ਸਾਡਾ ਵਧੀਆ ਸਾਡੇ ਸਾਹ ਲੈਣ ਦਾ ਤਰੀਕਾ ਸਾਡਾ ਵਧੀਆ ਹੋ ਜਾਂਦਾ ਹੈ ਸਾਡੇ ਅੰਦਰ ਆਪਾਂ ਛੇਤੀ ਨਹੀਂ ਥੱਕਦੇ ਸਾਡਾ ਸਾਰਾ ਕੁਛ ਹੀ ਠੀਕ ਹੋ ਜਾਂਦਾ